ਪਹਿਲਾਂ ਪੰਜਾਬੀ ਨੂੰ ਵਿੱਚ ਦੀ ਬੱਚਿਆਂ ਨੇ ਬਿਲਕੁਲ ਜਮਾਂ ਛੱਡ ਦਿੱਤਾ ਸੀ ਅਸੀਂ ਇੰਗਲਿਸ਼ ਬੜੀ ਅਹਿਮੀਅਤ ਦੇ ਦਿੱਤੀ ਸੀ ਹੁਣ ਕੁਛ ਸ਼ੋਸ਼ਲ ਮੀਡੀਆ ਕੁਛ ਸਰਕਾਰਾਂ ਵੱਲੋਂ ਪੰਜਾਬੀ ਨੂੰ ਬਹੁਤ ਤਰਜ਼ੀਹ ਦੇਣ ਨਾਲ ਇਹਦੇ ਨਾਲ ਕੀ ਹੋਇਆ ਕਿ ਸਾਡੀ ਪੰਜਾਬੀ ਹੋਰ ਜ਼ਿਆਦਾ ਵਿਕਸਿਤ ਹੋ ਰਹੀ ਹੈ ਤੁਸੀਂ ਦੇਖੋ ਹੋਰ ਦੇਸ਼ਾਂ 'ਚ ਚਲੇ ਜਾਓ ਉੱਥੇ ਇਹ ਨਹੀਂ ਕਹਿਣਗੇ ਵੀ ਇੱਥੇ ਅੰਗਰੇਜ਼ ਵੀ ਇੱਥੇ ਆਉਣਗੇ ਅਤੇ ਇੱਥੇ ਪੰਜਾਬੀ ਵੀ ਹੋਣਗੇ ਅਸੀਂ ਅੰਗਰੇਜ਼ੀ ਲਿਖ ਦਈਏ ਜਾਂ ਪੰਜਾਬੀ ਉਹ ਆਪਦੀ ਮੰਨ ਲਓ ਕੋਈ ਕਿਸੇ ਥਾਂ ਹੀ ਚਲੇ ਜਾਓ ਜਿਵੇਂ ਪੈਰਸ 'ਚ ਚਲੇ ਜਾਓ ਕਿਤੇ ਵੀ ਚਲੋ ਉਹ ਆਪਦੀ ਲੈਂਗੁਏਜ 'ਚ ਹੀ ਲਿਖਣਗੇ ਅਸੀਂ ਕੀ ਕਰਦੇ ਹਾਂ ਜੀ ਅਸੀਂ ਅੱਜ ਇੱਥੇ ਮੰਨ ਲਓ ਇੱਥੇ ਪੰਜਾਬ 'ਚ ਅਸੀਂ ਕੋਈ ਸਟਾਲ ਲਾਈਏ ਉਹਦੇ 'ਚ ਨਾਲ ਇੰਗਲਿਸ਼ 'ਚ ਵੀ ਲਿਖਾਂਗੇ ਪੰਜਾਬੀ 'ਚ ਵੀ ਲਿਖਾਂਗੇ ਕਿਉਂ ਅਸੀਂ ਵੀ ਪੰਜਾਬੀ 'ਚ ਲਿਖੀਏ ਤਾਂ ਕਿ ਅਗਲਾ ਪੰਜਾਬੀ ਸਿੱਖੇ ਅਤੇ ਫਿਰ ਉਹਨੂੰ ਪੜ੍ਹਨਾ ਸਿੱਖੇ ਇੱਦਾਂ ਅਸੀਂ ਤਬਦੀਲੀ ਕਰ ਸਕਦੇ ਹਾਂ ਹੋਰ ਵੀ ਵਧੀਆ ਕਰ ਸਕਦੇ ਹਾਂ ਹੋਈਆਂ ਵੀ ਬਹੁਤ ਨੇ ਪੰਜਾਬੀ ਨੂੰ ਵਿਕਸਿਤ ਭਾਸ਼ਾ ਨੂੰ ਵਿਕਸਿਤ ਕਰਨ 'ਚ ਅਤੇ ਬਹੁਤ ਵਧੀਆ ਪੰਜਾਬੀ ਅੱਗੇ ਵਿਕਸਿਤ ਹੋ ਰਹੀ ਹੈ ਕੁਛ ਸੱਭਿਆਚਾਰ ਦੁਆਰਾ ਕੁਛ ਗਾਇਕ ਜਿਵੇਂ ਕਹਿੰਦੇ ਨੇ ਕੁਛ ਸਿੰਗਰਾਂ ਦੁਆਰਾ ਕੇ ਕਿਹਾ ਕਿ ਪੰਜਾਬੀ ਨੂੰ ਅਹਿਮੀਅਤ ਦਿਓ ਜਿਵੇਂ ਊੜਾ ਆੜਾ ਚੱਲ ਪਿਆ ਦੁਬਾਰਾ ਊੜਾ ਆੜਾ ਭੁੱਲ ਗਏ ਸੀ ਸਾਰੇ ਜਣੇ ਹੁਣ ਦੁਬਾਰਾ ਚੱਲ ਪਿਆ ਸਟੋਲਾਂ 'ਤੇ ਸੋਲਾਂ 'ਤੇ ਆਉਣ ਲੱਗ ਗਿਆ